ਹਾਂਜੀ ਜਿਵੇਂ ਅਸੀਂ ਜਾਣਦੇ ਹਾਂ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਹ ਸਾਡੇ ਸਰੀਰਕ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਮੈਂ ਸਕੂਲ ਦੇ ਵਿੱਚ ਐਥਲੈਟਿਕਸ ਦੀ ਖਿਡਾਰੀ ਹੁੰਦੀ ਸੀ ਅਤੇ ਆਪਾਂ ਜਾਣਦੇ ਹਾਂ ਖਿਡਾਰੀਆਂ ਅਤੇ ਸੱਟਾਂ ਦਾ ਤਾਂ ਇੱਕ ਗੂੜਾ ਰਿਸ਼ਤਾ ਹੁੰਦਾ ਹੈ ਇੱਕ ਵਾਰ ਦੌੜਦੇ ਸਮੇਂ ਮੈਂ ਗਰਾਊਂਡ ਦੇ ਵਿੱਚ ਡਿੱਗ ਪਈ ਜਿਸ ਕਾਰਨ ਮੇਰੇ ਪੈਰ ਦੇ ਉੱਤੇ ਮੋਚ ਆ ਗਈ ਗੋਡੇ ਦੇ ਉੱਤੇ ਸੱਟ ਲੱਗੀ ਹੈ ਅਤੇ ਲੱਤ ਦੇ ਉੱਤੇ ਵੀ ਕਾਫੀ ਰਗੜਾਂ ਲੱਗ ਗਈਆਂ ਸੱਟ ਇੰਨੀ ਕੁ ਜ਼ਿਆਦਾ ਲੱਗ ਗਈ ਕਿ ਮੈਂ ਹੁਣ ਤੁਰ ਫਿਰ ਵੀ ਨਹੀਂ ਸੀ ਸਕਦੀ ਕਿਉਂਕਿ ਖੜ੍ਹੇ ਹੋਣ 'ਤੇ ਮੇਰੇ ਪੈਰ ਦੇ ਵਿੱਚ ਗੋਡੇ ਦੇ ਵਿੱਚ ਦਰਦ ਹੋ ਰਹੀ ਸੀ ਇਸ ਸੱਟ ਲਈ ਪਹਿਲਾਂ ਤਾਂ ਮੈਂ ਫਸਟ ਏਡ ਜਿਹੜੀ ਸੀਗੀ ਜਿਵੇਂ ਸਾਨੂੰ ਖੇਡਾਂ ਦੇ ਦੌਰਾਨ ਸਿਖਾਈ ਜਾਂਦੀ ਹੈ ਕਿ ਥੋੜ੍ਹੀ ਬਹੁਤੀ ਫਸਟ ਏਡ ਦੇ ਦਿਓ ਠੀਕ ਹੈ ਅਤੇ ਉਹ ਸੱਟ ਜਿਹੜੀ ਛੇਤੀ ਠੀਕ ਹੋ ਜਾਂਦੀ ਹੈ ਇਸ ਦੇ ਲਈ ਪਹਿਲਾਂ ਮੈਂ ਰਾਈਸ ਵਿਧੀ ਭਾਵ ਰੈਸਟ ਆਈਸ ਕੰਪਰੈਸ਼ਨ ਅਤੇ ਐਲੀਵੇਸ਼ਨ ਵਿਧੀ ਦੀ ਵਰਤੋਂ ਕੀਤੀ ਇਸ ਵਿਧੀ ਵਿੱਚ ਜਖ਼ਮੀ ਭਾਗ ਨੂੰ ਆਰਾਮ ਦੇਣਾ ਵਾਰ ਵਾਰ ਬਰਫ਼ ਰਗੜਨਾ ਇਸ 'ਤੇ ਦਬਾਓ ਪਾਉਣਾ ਅਤੇ ਇਸ ਨੂੰ ਉੱਚਾ ਰੱਖਣਾ ਆਦਿ ਕੀਤਾ ਤਾਂ ਕਿ ਜਿਹੜਾ ਮੇਰੇ ਗੋ ਗੋਡੇ ਦਾ ਅਤੇ ਪੈਰ ਦਾ ਦਰਦ ਸੀਗਾ ਉਹ ਠੀਕ ਹੋ ਜਾਵੇ ਇਸ ਕਿਰਿਆ ਦੇ ਰਾਹੀਂ ਜਿਹੜਾ ਆ ਮੈਨੂੰ ਕੁਝ ਰਾਹਤ ਮਿਲੀ ਕੁਝ ਆਰਾਮ ਮਿਲਿਆ ਇਸ ਤੋਂ ਇਲਾਵਾ ਮੇਰੀ ਮੰਮੀ ਨੇ ਮੇਰੀ ਸੱਟ ਦੇ ਉੱਤੇ ਘਰੇਲੂ ਇਲਾਜ ਕਰਨਾ ਜਿਵੇਂ ਮੋਚ ਦੇ ਉੱਤੇ ਆਈਓ ਡੈਕਸ ਮਲਣੀ ਸੇਕਾ ਦੇਣਾ ਹਲਦੀ ਵਾਲਾ ਦੁੱਧ ਪਿਆਉਣਾ ਇਹ ਸਾਰੇ ਤਰੀਕੇ ਜਿਹੜੇ ਕਰ ਕੁਰ ਕੇ ਮੇਰੀ ਮੰਮੀ ਨੇ ਮੇਰੀ ਸੱਟ ਨੂੰ ਛੇਤੀ ਤੋਂ ਛੇਤੀ ਰਾਜ਼ੀ ਕਰਨ ਦੇ ਵਿੱਚ ਮਦਦ ਕੀਤੀ ਇਸ ਤਰ੍ਹਾਂ ਚਾਰ ਪੰਜ ਦਿਨਾਂ ਦੀ ਮਿਹਨਤ ਤੋਂ ਬਾਅਦ ਇਹ ਮੇਰੀ ਸੱਟ ਠੀਕ ਹੋ ਗਈ ਅਤੇ ਮੈਂ ਮੁੜ ਗਰਾਉਂਡ ਦੇ ਵਿੱਚ ਖੇਡਣ ਦੇ ਲਈ ਤਿਆਰ ਹੋਈ